ਮੈਮ ਸਤਿ ਸ਼੍ਰੀ ਅਕਾਲ ਜੀ ਮੈਮ ਤੁਹਾਡਾ ਨਾਮ ਸਿਮਰਨ ਹੈ ਮੈਨੂੰ ਤੁਹਾਡਾ ਨੰਬਰ ਅਮਨ ਨੇ ਦਿੱਤਾ ਸੀ ਮੈਮ ਮੈਂ ਹੁਣੇ ਹੁਣੇ ਨਵੀਂ ਨਵੀਂ ਚੰਡੀਗੜ੍ਹ ਤੋਂ ਸੀਫਟ ਇੱਥੇ ਕਲੋਨੀ ਵਿੱਚ ਹੋਈ ਹਾਂ ਅਤੇ ਮੈਨੂੰ ਪਤਾ ਨਹੀਂ ਹੈ ਕਿ ਇੱਥੇ ਫਰੈਸ਼ ਸਬਜੀਆਂ ਕਿੱਥੋਂ ਮਿਲਦੀਆਂ ਕੀ ਤੁਸੀਂ ਮੇਰੀ ਕੁਛ ਮਦਦ ਕਰ ਸਕਦੇ ਹੋ ਹਾਂਜੀ ਮੈਮ ਉੱਥੇ ਸਾਡੇ ਚੰਡੀਗੜ੍ਹ ਤਾਂ ਐਵੇਂ ਘਰ ਦੇ ਅੱਗੇ ਹੀ ਸਬਜ਼ੀਆਂ ਮਿਲ ਜਾਂਦੀਆਂ ਸੀ ਫਰੈਸ਼ ਸੀ ਅਤੇ ਮੈਨੂੰ ਇੱਥੇ ਕੋਈ ਵੀ ਐਵੇਂ ਦੁਕਾਨ ਨਹੀਂ ਪਤਾ ਕਿ ਜਿੱਥੋਂ ਫ਼੍ਰੇਸ਼ ਸਬਜ਼ੀਆਂ ਮਿਲਦੀਆਂ ਹੋਣ ਅਤੇ ਮੈਂ ਤੁਹਾਡੀ ਹੈਲਪ ਲੈਣਾ ਚਾਹੁੰਦੀ ਹਾਂ ਹਾਂਜੀ ਮੈਮ ਅੱਛਾ ਜੀ ਅੱਛਾ ਜੀ ਅੱਛਾ ਜੀ ਅੱਛਾ ਜੀ ਹਾਂ ਹਾਂ ਮੈਮ ਤੁਸੀਂ ਮੇਰੇ ਨਾਲ ਚੱਲ ਸਕਦੇ ਹੋ ਹਾਂਜੀ ਮੈਮ ਮੈਮ ਕੱਲ੍ਹ ਹੀ ਚੱਲਦੇ ਹਾਂ ਹਾਂਜੀ ਹਾਂਜੀ ਹਾਂਜੀ ਮੈਂ ਤੁਹਾਨੂੰ ਪੁੱਛ ਲਵਾਂਗੀ ਇੱਕ ਵਾਰੀ ਜਾਂ ਫਿਰ ਤੁਸੀਂ ਮੈਨੂੰ ਦੱਸ ਦਿਉ ਇੱਕ ਵਾਰੀ ਕੋਲ ਕਰਕੇ ਕਿ ਤੁਸੀਂ ਕਦੋਂ ਫਰੀ ਹੋਊਂਗੇ ਹਾਂਜੀ ਚਲੋ ਠੀਕ ਹੈ ਮੈਮ ਥੈਂਕ ਯੂ